ਹੈਲੋ ਹਾਂਜੀ ਤੁਸੀਂ ਗੁਰਪ੍ਰੀਤ ਸਿੰਘ ਗੱਲ ਕਰ ਰਹੇ ਹੋ ਜੀ ਮੈਂ ਸੁਖਮਣੀ ਕੌਰ ਗੱਲ ਕਰ ਰਹੀ ਸੀ ਵੀਰ ਜੀ ਮੈਂ ਇਸ ਕਰਕੇ ਫੋਨ ਕੀਤਾ ਸੀ ਕਿ ਤੁਸੀਂ ਮੈਨੂੰ ਰਾਤ ਘਰ ਛੱਡ ਕੇ ਗਏ ਸੀ ਹਾਂਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਰਾਤ ਮੌਸਮ ਬਹੁਤ ਖ਼ਰਾਬ ਸੀ ਜ਼ਿਆਦਾ ਧੁੰਦ ਕਾਰਣ ਤੁਹਾਨੂੰ ਗੱਡੀ ਚਲਾਉਣ ਵਿੱਚ ਵੀ ਬਹੁਤ ਦਿੱਕਤ ਆਈ ਪਰ ਫਿਰ ਵੀ ਤੁਸੀਂ ਬਹੁਤ ਵਧੀਆ ਢੰਗ ਨਾਲ ਗੱਡੀ ਚਲਾਈ ਅਤੇ ਮੈਨੂੰ ਟਾਈਮਲੀ ਘਰ ਛੱਡ ਦਿੱਤਾ ਮੇਰੇ ਪਰਿਵਾਰ ਦੇ ਮੈਂਬਰ ਵੀ ਮੌਸਮ ਖ਼ਰਾਬ ਹੋਣ ਕਾਰਨ ਟੈਂਸ਼ਨ ਵਿੱਚ ਸਨ ਪਰ ਸਮੇਂ ਸਿਰ ਮੈਨੂੰ ਘਰ ਵਿੱਚ ਦੇਖ ਕੇ ਉਹ ਵੀ ਹੈਰਾਨ ਹੋਏ ਅਤੇ ਜਿਸ ਕਰਕੇ ਉਹ ਤੁਹਾਡਾ ਦਿਲੋਂ ਧੰਨਵਾਦ ਕਰਦੇ ਸਨ ਸਾਰੇ ਅੱਗੇ ਤੋਂ ਵੀ ਜੇਕਰ ਸਾਨੂੰ ਗੱਡੀ ਦੀ ਲੋੜ ਹੋਈ ਤਾਂ ਅਸੀਂ ਤੁਹਾਨੂੰ ਹੀ ਫੋਨ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ